ਵੈਸੇ ਤਾਂ ਹਰ ਕੋਈ ਪੰਜਾਬੀ ਪੰਜਾਬੀ ਭਾਸ਼ਾ ਬੋਲਦਾ ਹੈ ਜਾਂ ਜੋ ਪੰਜਾਬ ਦਾ ਰਹਿਣ ਵਾਲਾ ਹੈ ਉਹ ਹਰ ਬੰਦਾ ਜਾਣਦਾ ਹੈ ਕਿ ਪੰਜਾਬੀ ਭਾਸ਼ਾ ਕਿਵੇਂ ਬੋਲੀ ਜਾਂਦੀ ਹੈ ਅਤੇ ਕਿਸ ਤਰੀਕੇ ਦੀ ਇਹ ਭਾਸ਼ਾ ਹੈ ਪੰਜਾਬੀ ਭਾਸ਼ਾ ਗੱਲ ਕਰੀਏ ਤਾਂ ਇਹ ਹਿੰਦੀ ਭਾਸ਼ਾ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਹੈ ਜਾਂ ਇਹਨੇ ਹਿੰਦੀ ਭਾਸ਼ਾ ਨੂੰ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਕਿਉਂਕਿ ਪੰਜਾਬੀ ਅਤੇ ਹਿੰਦੀ ਇੱਕ ਦੂਸਰੇ ਨਾਲ ਕਨੈਕਟਡ ਨੇ ਕਿਉਂਕਿ ਹਿੰਦੀ ਭਾਸ਼ਾ 'ਚੋਂ ਹੀ ਪੰਜਾਬੀ ਭਾਸ਼ਾ ਨਿਕਲੀ ਹੈ ਜੇ ਗੱਲ ਕਰੀਏ ਪੰਜਾਬੀ ਭਾਸ਼ਾ ਦੀ ਤਾਂ ਪੰਜਾਬੀ ਭਾਸ਼ਾ ਦੇ ਵਿੱਚ ਕਾਫੀ ਜ਼ਿਆਦਾ ਯੋਗਦਾਨ ਹਿੰਦੀ ਦਾ ਹੀ ਰਿਹਾ ਹੈ ਹਿੰਦੀ ਭਾਸ਼ਾ ਨੇ ਕਾਫੀ ਜ਼ਿਆਦਾ ਪੰਜਾਬੀ ਭਾਸ਼ਾ ਨੂੰ ਨਿਖਾਰਿਆ ਹੈ ਕਿਉਂਕਿ ਹਿੰਦੀ ਹਿੰਦੀ ਭਾਸ਼ਾ 'ਚੋਂ ਹੀ ਪੰਜਾਬੀ ਭਾਸ਼ਾ ਆਈ ਹੈ ਪੰਜਾਬੀ ਭਾਸ਼ਾ ਕਾਫੀ ਜ਼ਿਆਦਾ ਇੱਕ ਰੰਗਲੀ ਭਾਸ਼ਾ ਹੈ ਹਰ ਪੰਜਾਬੀ ਇਸ ਨੂੰ ਬੋਲਣ ਦੇ ਵਿੱਚ ਜ਼ਿਆਦਾ ਝਿਜਕ ਝਕਾਉਂਦਾ ਨਹੀਂ ਪੰਜਾਬੀ ਭਾਸ਼ਾ ਕਾਫੀ ਜ਼ਿਆਦਾ ਸੋਹਣੀ ਭਾਸ਼ਾ ਹੈ ਬਾਕੀ ਤੁਹਾਨੂੰ ਸਮਝਣ ਦੀ ਗੱਲ ਹੈ ਕਿ ਪੰਜਾਬੀ ਤੁਸੀਂ ਕਿਸ ਤਰੀਕੇ ਨਾਲ ਬੋਲਦੇ ਪਏ ਹੋ ਪੰਜਾਬੀ ਬੋਲਣ 'ਚ ਹਰ ਪੰਜਾਬੀ ਸ਼ਰਮਾਉਂਦਾ ਨਹੀਂ ਹੈ ਬਲਕਿ ਪੰਜਾਬੀ ਬੋਲ ਕੇ ਦੱਸਦਾ ਹੈ ਪੰਜਾਬੀ ਬੋਲਣਾ ਕਾਫੀ ਜ਼ਿਆਦਾ ਵਧੀਆ ਗੱਲ ਹੈ ਕਿਉਂਕਿ ਆਪਣੀ ਭਾਸ਼ਾ ਨੂੰ ਬੋਲਣਾ ਇੱਕ ਬਹੁਤ ਵਧੀਆ ਗੱਲ ਹੋ ਜਾਂਦੀ ਹੈ ਪੰਜਾਬੀ ਭਾਸ਼ਾ ਕਾਫੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਦੂਸਰੇ ਲੋਕਾਂ ਨੂੰ ਵੀ ਕਿਉਂਕਿ ਕਾਫੀ ਅਲੱਗ ਜਿਹੀ ਭਾਸ਼ਾ ਲੱਗਦੀ ਹੈ ਜੇ ਤੁਸੀਂ ਦੂਸਰੀ ਜਗ੍ਹਾ ਜਾ ਕੇ ਵੀ ਪੰਜਾਬੀ ਬੋਲੋਗੇ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਇਹ ਹਿੰਦੀ ਤੋਂ ਹੀ ਲੱਗੇਗੀ ਅਤੇ ਉਹਨਾਂ ਨੂੰ ਸਮਝ ਵੀ ਆ ਜਾਏਗੀ ਕਿ ਪੰਜਾਬੀ 'ਚ ਇਹ ਬੰਦਾ ਬੋਲ ਕੀ ਰਿਹਾ ਪੰਜਾਬੀ ਭਾਸ਼ਾ ਇਸ ਲਈ ਕਾਫੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਹਰ ਪੰਜਾਬੀ ਲਈ ਬੋਲਣੀ ਕਿਉਂਕਿ ਇਹ ਪੰਜਾਬੀ ਭਾਸ਼ਾ ਜ਼ਰੂਰਤ ਦੀ ਵੀ ਨਾ ਗੱਲ ਕਰੀਏ ਤਾਂ ਇਹ ਹਰ ਬੰ ਹਰ ਪੰਜਾਬੀ ਬੰਦੇ ਨੂੰ ਆ ਜਾਂਦੀ ਹੈ ਵੈਸੇ ਤਾਂ ਹਰ ਕੋਈ ਇਸ ਬੰਦੇ ਹਰ ਕੋਈ ਬੰਦਾ ਇਸ ਭਾਸ਼ਾ ਨੂੰ ਬੋਲ ਸਕਦਾ ਹੈ ਜੇ ਉਸ ਨੇ ਇੱਕ ਵਾਰੀ ਪੰਜਾਬੀ ਭਾਸ਼ਾ ਨੂੰ ਸੁਣ ਲਿਆ ਤਾਂ ਉਹ ਹੌਲੀ ਹੌਲੀ ਉਹ ਸਮਝ ਕੇ ਪੰਜਾਬੀ ਵੀ ਬੋਲਣਾ ਸਟਾਰਟ ਕਰ ਸਕਦਾ ਹੈ ਇਸ ਲਈ ਪੰਜਾਬੀ ਭਾਸ਼ਾ ਨੇ ਕਾਫੀ ਸਾਰੇ ਲੋਕਾਂ ਨੂੰ ਪ੍ਰਭਾਵਿਤ ਵੀ ਕੀਤਾ ਖ਼ਾਸ ਕਰ ਭਾਰਤ ਦੇ ਵਿੱਚ ਤਾਂ ਕਾਫੀ ਸਾਰੇ ਲੋਕ ਕਾਫੀ ਸਾਰੇ ਸ਼ਹਿਰਾਂ ਦੇ ਲੋਕ ਅੱਜ ਕੱਲ੍ਹ ਪੰਜਾਬੀ ਬੋਲ ਸਕਦੇ ਨੇ ਜੇ ਤੁਸੀਂ ਦਿੱਲੀ ਵਾਲੀ ਸਾਈਡ ਵੀ ਚੱਲ ਜਾਓਗੇ ਤਾਂ ਕਾਫੀ ਸਾਰੇ ਲੋਕ ਪੰਜਾਬੀ ਗਾਣੇ ਸੁਣਦੇ ਨੇ ਪੰਜਾਬੀ ਭਾਸ਼ਾ ਨੂੰ ਸੁਣਦੇ ਨੇ ਇਸ ਲਈ ਪੰਜਾਬੀ ਕਾਫੀ ਜ਼ਿਆਦਾ ਪ੍ਰਭਾਵਸ਼ਾਲੀ ਰਹੀ ਹੈ